ਮੈਂ ਕੁਕਿੰਗ ਸਿੱਖੀ ਨਹੀਂ ਲੇਕਿਨ ਮੈਨੂੰ ਨਾ ਕੁਕਿੰਗ ਦਾ ਬਹੁਤ ਸ਼ੌਕ ਹੈ ਜਿਸ ਤਰ੍ਹਾਂ ਸਬਜ਼ੀ ਬਣਾਉਣੀ ਕਰੇਲੇ ਹੈ ਫਰਾਈ ਕਰਕੇ ਆਪਾਂ ਮਸਾਲਾ ਗਰੈਂਡ ਕਰਕੇ ਭਰ ਕੇ ਬਣਾਉਂਦੇ ਉਹ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਮੈਂ ਜੋ ਮੇਰਾ ਬੱਚਾ ਕ ਚਾਹੁੰਦਾ ਮੈਂ ਇੰਟਰਨੈੱਟ 'ਤੇ ਕੱਢ ਕੇ ਅਤੇ ਉਹੀ ਚੀਜ਼ ਬਣਾਉਣੀ ਸਿੱਖਦੀ ਹਾਂ ਪੀਜ਼ਾ ਹੋ ਗਿਆ ਪੀਜ਼ਾ ਅਸੀਂ ਮਾਰਕਿਟ ਤੋਂ ਲਿਆਉਂਦੇ ਨਹੀਂ ਅਸੀਂ ਚਾਹੁੰਦੇ ਬੱਚੇ ਨੂੰ ਅਸੀਂ ਆਪਣੇ ਘਰ ਬਣਾ ਕੇ ਅੱਛੀ ਤਰ੍ਹਾਂ ਕਿ ਖੁਆਈਏ ਫਿਰ ਅਸੀਂ ਉਹ ਚੀਜ਼ ਘਰ ਆਪਣੇ ਓਵਨ 'ਚ ਅੱਛੀ ਤਰ੍ਹਾਂ ਸ਼ਿਮਲਾ ਮਿਰਚ ਵਗੈਰਾ ਹੋਰ ਫਰੂਟ ਚੀਜ਼ ਵਗੈਰਾ ਪਾ ਕੇ ਅਸੀਂ ਅੱਛਾ ਤਰ੍ਹਾਂ ਉਹਨੂੰ ਘਰ ਪੀਜ਼ੇ ਨੂੰ ਬਣਾ ਸਕਦੇ ਹਾਂ ਆਪਣੇ ਬੱਚੇ ਨੂੰ ਚੰਗਾ ਖਾਣਾ ਦੇ ਸਕਦੇ ਹਾਂ ਅਤੇ ਜੇ ਅਸੀਂ ਘਰ ਅੱਛੀ ਅੱਛੀਆਂ ਸਬਜ਼ੀਆਂ ਬਣਾਉਗੇ ਸਾਨੂੰ ਬਾਹਰ ਦੀ ਚੀਜ਼ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਘਰ ਐਨੇ ਵਧੀਆ ਵਧੀਆ ਸਬਜ਼ੀਆਂ ਬਣਾਈ ਦੀਆਂ ਸ਼ਿਮਲਾ ਮਿਰਚ ਹੋ ਗਈ ਬੈਂਗਣ ਦਾ ਭੜਥਾ ਹੋ ਗਿਆ ਜੋ ਬੱਚਿਆਂ ਨੂੰ ਪਸੰਦ ਹੈ ਅਸੀਂ ਉਹਨੂੰ ਅੱਛੀ ਤਰ੍ਹਾਂ ਬਣਾ ਕੇ ਘਰ ਬਣਾਉ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਅਸੀਂ ਆਪਣੇ ਘਰ ਅੱਛਾ ਖਾਣਾ ਬਣਾ ਸਕਦੇ ਨੈੱਟ 'ਤੇ ਅੱਜ ਕੱਲ੍ਹ ਸਭ ਕੁਝ ਸਰਚ ਮਾਰ ਕੇ ਕੱਢ ਲਉ ਅਤੇ ਕੁਛ ਵੀ ਆਪਾਂ ਬਣਾ ਸਕਦੇ ਹਾਂ ਆਲੂ ਦਾ ਪਰੌਠਾ ਹੋ ਗਿਆ ਕੋਈ ਵੀ ਟੇਸਟੀ ਚੀਜ਼ ਕੁਛ ਵੀ ਸਾਨੂੰ ਬਾਹਰ ਦੀ ਚੀਜ਼ ਨਹੀਂ ਪਸੰਦ ਆ ਸਕਦੀ ਮਨ ਕਰਦਾ ਪਕੌੜੇ ਹੋ ਗਏ ਬਾਹਰੋਂ ਨਹੀਂ ਬਣਾਉਣੇ ਘਰ ਪਨੀਰ ਦੇ ਪਕੌੜੇ ਅਸੀਂ ਅੱਛੀ ਤਰ੍ਹਾਂ ਬਣਾ ਸਕਦੇ ਖਾ ਸਕਦੇ ਆਪਣੇ ਬੱਚੇ ਨੂੰ ਫੇਰ ਕੋਈ ਗੈਸਟ ਆ ਗਿਆ ਕੋਈ ਚੀਜ਼ ਤਿਆਰ ਕਰਨੀ ਆਪਣੇ ਘਰ ਆਪਾਂ ਪਕੌੜੇ ਹੋ ਗਏ ਪਨੀਰ ਦੇ ਗੋਭੀ ਦੇ ਹੋ ਗਏ ਅੱਛੀ ਚੀਜ਼ ਬਣਾ ਕੇ ਉਹਨਾਂ ਨੂੰ ਕਰ ਸਕਦੇ